ਮੈਂ ਇੱਕ ਦਿਨ ਆਪਣੇ ਲਈ ਇੱਕ ਹੋਮ ਡਿਲੀਵਰੀ ਕੀਤੀ ਜੀਨ ਜੀਨ ਮੰਗਵਾਈ ਜੀਨ ਦੀ ਪੈਂਟ ਪਰ ਜਦੋਂ ਮੇਰੇ ਕੋਲ ਉਹ ਪੁੱਜੀ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਪ੍ਰੋਡਕਟ ਨੂੰ ਤਾਂ ਬੜੀ ਲੋਅ ਕੁਆਲਿਟੀ ਦੀ ਪੈਂਟ ਸੀਗੀ ਉਹ ਜਿਹੜੀ ਪਹਿਲਾਂ ਤਾਂ ਦੇਖਣ ਨੂੰ ਏ ਬਹੁਤ ਪੁਰਾਣੀ ਜਿਹੀ ਲੱਗ ਰਹੀ ਸੀਗੀ ਮੈਂ ਸੋਚਿਆ ਵੀ ਇਹਦੀ ਜਿਹੜੀ ਕੀਮਤ ਇਹਨਾਂ ਨੇ ਵਸੂਲ ਕੀਤੀ ਹੈ ਉਹ ਬਿਲਕੁਲ ਇੱਕ ਧੋਖਾ ਫਰੋਡ ਆ ਮੇਰੇ ਨਾਲ ਅਤੇ ਉਹਦੀ ਜਿਪ ਵਗੈਰਾ ਵੀ ਵਿੱਚੋਂ ਖੋਲਣ 'ਤੇ ਖਰਾਬ ਨਿਕਲੀ ਜਿਹੜੀ ਦੇਖਣ 'ਚ ਉਹਦੀ ਸਿਲਾਈਆਂ ਵੀ ਜਿਹੜੀਆਂ ਸੀਗੀਆਂ ਮੈਨੂੰ ਕੋਈ ਵਾਲੀਆਂ ਠੀਕ ਨਹੀਂ ਲੱਗੀਆਂ ਅਤੇ ਇੱਕ ਕਿਸਮ ਦੀ ਉਹ ਪੈਂਟ ਜਿਹੜੀ ਸੀਗੀ ਇਸ ਤਰ੍ਹਾਂ ਲੱਗ ਰਹੀ ਸੀ ਕਿ ਜਿਵੇਂ ਕੋਈ ਸੈਕਿੰਡ ਹੈਂਡ ਟੈਪ ਦੀ ਪੈਂਟ ਹੋਵੇ ਬਾਕੀ ਜਿਹੜਾ ਹੋਮ ਡਿਲਵਰੀ ਵਾਲਾ ਬੰਦਾ ਸੀ ਉਹਨੇ ਮੈਨੂੰ ਉਸੇ ਟਾਈਮ ਕਿਹਾ ਕਿ ਪ੍ਰੋਡਕਟ ਖੋਲਣ ਤੋਂ ਮਨ੍ਹਾ ਕੀਤਾ ਕਿ ਤੁਸੀਂ ਇਹਨੂੰ ਪਹਿਲਾਂ ਜੋ ਔਡਰ ਹ ਅ ਦੀ ਰਿਸੀਪਟ ਹੈ ਉਸ 'ਤੇ ਸਾਈਨ ਕਰ ਦੋਵੋ ਅਤੇ ਜਿਹੜਾ ਮੈਂ ਸੈਨ ਕਰ ਦਿੱਤੇ ਉਹਦੇ ਕਹਿਣ 'ਤੇ ਪਰ ਬਾਅਦ ਵਿੱਚ ਜਦੋਂ ਮੈਂ ਪੈਂਟ ਖੋਲ ਕੇ ਕੁਆਲਿਟੀ ਉਹਦੀ ਚੈੱਕ ਕੀਤੀ ਮੇਰਾ ਮਨ ਬੜਾ ਖਰਾਬ ਹੋਇਆ ਅਤੇ ਮੈਂ ਪੈਸੇ ਦੀ ਵੀ ਉਹਦੀ ਬੇਫਜ਼ੂਲ ਆਪਣੇ ਦੀ ਬਰਬਾਦੀ ਸਮਝੀ ਇਸ ਤਰ੍ਹਾਂ ਮੇਰਾ ਬੜਾ ਨੈਗਟਿਵ ਐਕਸਪੀਰੀਅਸ ਰਿਹਾ ਹੈ ਇਸ ਹੋਮ ਡਿਲੀਵਰੀ ਤੋਂ